ਆਵਾਜਾਈ ਦੇ ਸਾਧਨ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਬਸ ਰੇਲ ਗੱਡੀ ਉਸ ਤੋਂ ਬਾਅਦ ਪਰਸਨਲ ਵਹੀਕਲਸ ਕਮਰਸ਼ੀਅਲ ਵਹੀਕਲਸ ਆ ਜਾਂਦੇ ਆ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਆਵਾਜਾਈ ਦੇ ਯਾਤਰਾ ਦੇ ਵਿੱਚ ਜੋ ਵਿਕਲਪ ਹੈ ਸਭ ਤੋਂ ਪਹਿਲਾਂ ਰੇਲ ਗੱਡੀ ਟਰੇਨ ਦੀ ਗੱਲ ਕਰੋ ਉਸ ਦੇ ਵਿੱਚ ਕੀ ਹੈ ਕਿ ਉਹ ਪੂਰਾ ਆਲ ਇੰਡੀਆ ਆਲ ਵਰਲਡ ਦੇ ਵਿੱਚ ਟਰੇਨ ਲਾਈਨਜ਼ ਹੈ ਟਰੈਕ ਬਣੇ ਹੋਏ ਆ ਤਾਂ ਹਰ ਇੱਕ ਦੇਸ਼ ਦੇ ਵਿੱਚ ਆਪਣਾ ਆਪਣਾ ਇੱਕ ਟਰੈਕ ਹੈ ਆਪਣੇ ਆਪਣੇ ਇੱਕ ਪਲੇਟਫਾਰਮ ਹੈ ਅਤੇ ਇਸ ਦੇ ਵਿੱਚ ਕੀ ਹੈ ਕਿ ਜੋ ਰੇਲ ਗੱਡੀ ਹੈ ਸਭ ਦੇ ਲਈ ਇਹ ਇੱਕ ਅਪਰੋਚੇਬਲ ਜੋ ਵਿਕਲਪ ਹੈ ਯਾਤਰਾ ਦਾ ਆਵਾਜਾਈ ਦਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਕਿਸੇ ਹੋਰ ਵੱਡੇ ਸ਼ਹਿਰ ਜਾਣ ਲਈ ਇੱਕ ਬੜਾ ਵਧੀਆ ਦਾ ਯਾਤਰਾ ਦਾ ਵਿਕਲਪ ਹੈ ਜਿਸ ਦਾ ਕਿ ਜੋ ਕਿਰਾਇਆ ਹੈ ਉਹ ਵੀ ਬੜਾ ਘੱਟ ਹੈ ਕਿ ਉਹਨੂੰ ਹਰੇਕ ਗਰੀਬ ਇਨਸਾਨ ਵੀ ਅਫੋਰਡ ਕਰ ਲੈਂਦਾ ਤਾਂ ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਜੋ ਸਫਰ ਹੈ ਬੜਾ ਆਰਾਮਦਾਇਕ ਹੁੰਦਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਵਾਜਾਈ ਦੇ ਕੁਝ ਨਵੇਂ ਢੰਗ ਕੀ ਹੈ ਜੋ ਪਹਿਲਾਂ ਨਹੀਂ ਸਨ ਆਵਾਜਾਈ ਦੇ ਜੋ ਨਵੇਂ ਢੰਗ ਹਨ ਜਿਵੇਂ ਕਿ ਰੇਲ ਗੱਡੀ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਜਦੋਂ ਪਹਿਲਾਂ ਰੇਲ ਯਾਤਰਾ ਹੁੰਦੀ ਸੀ ਉਸ ਦੇ ਵਿੱਚ ਸਿਰਫ ਪਲੇਟਫਾਰਮ 'ਤੇ ਬੋਲਿਆ ਜਾਂਦਾ ਸੀ ਕਿ ਵੀ ਇਹ ਗੱਡੀ ਇੰਨੇ ਨੰਬਰ ਦੀ ਗੱਡੀ ਇਸ ਪਲੇਟਫਾਰਮ 'ਤੇ ਆ ਰਹੀ ਹੈ ਜਾਂ ਉੱਥੇ ਬੋਲਿਆ ਸੀ ਕਿ ਇਹ ਗੱਡੀ ਇੰਨਾ ਟਾਈਮ ਲੇਟ ਹੈ ਜਾਂ ਉਹ ਇਸ ਟਰੈਕ 'ਤੇ ਆਏਗੀ ਤਾਂ ਹੁਣ ਕੀ ਹੈ ਕਿ ਅਸੀਂ ਕੋਈ ਵੀ ਟ੍ਰੇਨ ਆ ਜਿਸ ਟਰੇਨ 'ਤੇ ਅਸੀਂ ਜਾਂ ਜਿਸ ਰੇਲ ਗੱਡੀ 'ਤੇ ਅਸੀਂ ਸਫਰ ਕਰਨਾ ਉਸ ਰੇਲ ਗੱਡੀ ਦੀ ਜੋ ਟਾਈਮਿੰਗ ਹੈ ਵੀ ਕਦੋਂ ਉਹ ਆਪਣਾ ਸਫਰ ਸ਼ੁਰੂ ਕਰੇਗੀ ਰੇਲ ਗੱਡੀ ਕਿਹੜੇ ਸ਼ਹਿਰ ਤੋਂ ਚੱਲੇਗੀ ਉਹ ਰੇਲ ਗੱਡੀ ਤਾਂ ਉਹ ਕਿਹੜੇ ਸ਼ਹਿਰ ਤੋਂ ਅਸੀਂ ਚੜ੍ਹਨਾ ਵੀ ਉਸ ਸ਼ਹਿਰ ਦੇ ਵਿੱਚ ਉਹ ਕਦੋਂ ਐਂਟਰ ਕਰੇਗੀ ਅਤੇ ਅਸੀਂ ਉਸ ਹਿਸਾਬ ਨਾਲ ਇਹ ਕਹਿ ਸਕਦੇ ਕਿ ਸਾਡੇ ਕੋਲ ਇੱਕ ਉਸ ਰੇਲ ਗੱਡੀ ਦਾ ਜੋ ਕੀ ਹੈ ਲਾਈਵ ਜੋ ਟੈਲੀਕਾਸਟ ਹੈ ਕਿ ਗੱਡੀ ਕਦੋਂ ਆਈ ਕਿੱਥੋਂ ਚੱਲੀ ਕਿੱਥੋਂ ਤੱਕ ਕਿੱਥੇ ਪਹੁੰਚੇਗੀ ਉਹਦਾ ਸਾਰਾ ਜੋ ਹਿਸਾਬ ਕਿਤਾਬ ਆ ਸਾਨੂੰ ਇੱਕ ਉਸ ਐਪਲੀਕੇਸ਼ਨ ਦੇ ਵਿੱਚ ਮਿਲ ਜਾਂਦਾ ਜਿਹੜੀ ਐਪਲੀਕੇਸ਼ਨ ਨਾਮ ਹੈ ਵੇਅਰ ਇਜ ਮਾਈ ਟਰੇਨ ਤਾਂ ਉਹ ਵਿਕਲਪ ਜੋ ਹੈ ਬੜਾ ਰੇਲ ਗੱਡੀ ਦੇ ਵਿੱਚ ਬੜਾ ਅੱਛਾ ਲੱਗਿਆ ਕਿ ਤੁਹਾਨੂੰ ਕੋਈ ਵਾਹਲਾ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਜਾਂ ਜ਼ਿਆਦਾ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਆਪ ਉਸ ਗੱਡੀ ਦੀ ਜੋ ਲੋਕੇਸ਼ਨ ਹੈ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਸ ਜਗ੍ਹਾ 'ਤੇ ਉਹ ਪਹੁੰਚੀ ਹੈ ਕਦੋਂ ਤੱਕ ਉਹ ਆਪਣੇ ਸਟੇਸ਼ਨ ਤੱਕ ਉਸ ਨੇ ਪਹੁੰਚਣਾ ਹੈ ਤਾਂ ਇਹ ਵਿਕਲਪ ਬਹੁਤ ਅੱਛਾ ਹੈ ਆਵਾਜਾਈ ਅਤੇ ਯਾਤਰਾ ਦਾ ਤਾਂ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਲੋਕਲ ਬੱਸਸ ਜੋ ਬੱਸਾਂ ਹੁੰਦੀਆਂ ਨੇ ਜਿਵੇਂ ਹਰ ਰੋਜ਼ ਅਸੀਂ ਡਿਊਟੀ ਤੋਂ ਅਪ ਡਾਊਨ ਕਰਦੇ ਹਾਂ ਪੱਚੀ ਕਿਲੋ ਮੀਟਰ ਤਾਂ ਉਹ ਜੋ ਬੱਸ ਦੀ ਯਾਤਰਾ ਹੈ ਉਹ ਵੀ ਬੜੀ ਅੱਛਾ ਵਿਕਲਪ ਹੈ ਹੁਣ ਜੋ ਬੱਸਾਂ ਪਹਿਲਾਂ ਜੋ ਬੱਸ ਸਰਵਿਸ ਬੜੀ ਘੱਟ ਹੁੰਦੀ ਸੀ ਲੇਕਿਨ ਹੁਣ ਜੋ ਬੱਸ ਸਰਵਿਸ ਹੈ ਬਹੁਤ ਵਧੀਆ ਹੋ ਗਈ ਹੈ ਅਤੇ ਕਿਉਂਕਿ ਮੇਨ ਰੋਡ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਰੋਡ ਬਣੇ ਹੋਏ ਆ ਆਪਣਾ ਸਫਰ ਸ਼ੁਰੂ ਕਰੋ ਆਪਣੇ ਡੈਸਟੀਨੇਸ਼ਨ 'ਤੇ ਪਹੁੰਚੋ ਹੈ ਨਾ ਤਾਂ ਉਹ ਵੀ ਜੋ ਆਵਾਜਾਈ ਦਾ ਬੜਾ ਵਧੀਆ ਇੱਕ ਸਾਧਨ ਹੈ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਐਰੋਪਲੇਨ ਦੀ ਐਰੋਪਲੇਨ ਜਿਵੇਂ ਜਹਾਜ਼ ਹੋਗੇ ਉਹ ਉਹ ਸਵਾਰੀਆਂ ਵਾਲੇ ਜਹਾਜ਼ ਜਿਵੇਂ ਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿੱਚ ਡੋਮੈਸਟਿਕ ਜੋ ਹੁੰਦੇ ਨੇ ਪਲੇਨ ਤਾਂ ਇੰਟਰਨੈਸ਼ਨਲ ਪਲੇਨਸ ਵੀ ਹੁੰਦੇ ਨੇ ਜਿਵੇਂ ਕਿਸੇ ਕੰਟਰੀ ਤੋਂ ਕਿਸੇ ਦੂਸਰੀ ਕੰਟਰੀ ਜਾਣਾ ਤਾਂ ਉਹ ਵਿਕਲਪ ਵੀ ਬਹੁਤ ਅੱਛੇ ਨੇ ਮਤਲਬ ਤੁਸੀਂ ਕੁਝ ਘੰਟਿਆਂ ਦੇ ਵਿੱਚ ਜਾਂ ਮਤਲਬ ਆਪਣੀ ਡੈਸਟੀਨੇਸ਼ਨ 'ਤੇ ਪਹੁੰਚ ਸਕਦੇ ਹੋ ਤਾਂ ਉਸ ਤੋਂ ਇਲਾਵਾ ਜੋ ਆਵਾਜਾਈ ਅਤੇ ਯਾਤਰਾ ਦੇ ਹੋਰ ਜੋ ਕਮਰਸ਼ੀਅਲ ਵਹੀਕਲ ਹੈ ਕਿ ਜਿਵੇਂ ਤੁਸੀਂ ਟੂਰ 'ਤੇ ਜਾਣਾ ਵਿੱਧ ਫੈਮਲੀ ਜਾਣਾ ਤਾਂ ਤੁਸੀਂ ਕੋਈ ਵਹੀਕਲ ਹਾਇਰ ਕਰ ਸਕਦੇ ਹੋ ਇੱਕ ਦਿਨ ਦੇ ਲਈ ਇੱਕ ਹਫਤੇ ਦੇ ਲਈ ਹੈ ਨਾ ਤਾਂ ਉਸ ਲਈ ਤੁਸੀਂ ਪੇ ਕਰੋ ਉਹ ਉਸ ਤੋਂ ਇਲਾਵਾ ਜਿਵੇਂ ਜੇ ਆਪਾਂ ਗੱਲ ਕਰੀਏ ਨਵੀਂ ਟੈਕਨੀਕ ਦੀ ਤਾਂ ਓਲਾ ਕੈਬ ਹੋਗੀ ਹੈ ਨਾ ਇਸ ਤਰ੍ਹਾਂ ਦੇ ਕੈਬ ਆ ਜੋ ਕਿ ਸਾਨੂੰ ਔਨਲਾਈਨ ਜੋ ਕਮਰਸੀਅਲ ਵਹੀਕਲ ਅਵੇਲ ਕਰਵਾ ਦਿੰਦੇ ਆ ਅਤੇ ਬੜਾ ਉਹ ਅੱਛਾ ਹੈ ਉਸ ਤੋਂ ਬਾਅਦ ਆਪਣੇ ਪਰਸਨਲ ਵਹੀਕਲਸ ਹੋ ਗਏ ਲਾਈਕ ਮੋਟਰ ਸਾਈਕਲ ਜਾਂ ਆਪਣੀ ਪਰਸਨਲ ਕਾਰਾਂ ਹੈ ਨਾ ਤਾਂ ਕਾਫੀ ਵਿਕਲਪ ਨੇ ਜੋ ਕਿ ਆਵਾਜਾਈ ਅਤੇ ਯਾਤਾਯਾਤ ਨੂੰ ਹੋਰ ਸੁਖਾਲਾ ਕਰ ਦਿੰਦੇ ਆ ਸਾਡੇ ਲਈ ਧੰਨਵਾਦ